ਕੋਵਿਡ ਉੱਨੀ ਮਹਾਂਮਾਰੀ ਦੌਰਾਨ ਸਾਡੇ ਖੇਤਰ ਵਿੱਚ ਸਥਿਤੀ ਬਹੁਤ ਹੀ ਗੰਭੀਰ ਸੀ ਅਤੇ ਬਹੁਤ ਸਾਰੇ ਲੋਕ ਘਰ ਦੇ ਅੰਦਰ ਹੀ ਰਹਿੰਦੇ ਹਨ ਅਸੀਂ ਵੀ ਕੁਛ ਇਸ ਤਰ੍ਹਾਂ ਹੀ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਿਆ ਅਸੀਂ ਵੀ ਬਾਹਰ ਨਹੀਂ ਸੀ ਨਿਕਲਦੇ ਜੇਕਰ ਕੋਈ ਜ਼ਰੂਰੀ ਕੰਮ ਹੋਵੇ ਤਾਂ ਕੋਈ ਪਰਿਵਾਰ ਵਿੱਚੋ ਇੱਕ ਵਿਅਕਤੀ ਹੀ ਬਾਹਰ ਜਾਂਦਾ ਸੀ ਅਤੇ ਆਪਣਾ ਕੰਮ ਕਰਕੇ ਜਾਂ ਕੋਈ ਸਮਾਨ ਲੈ ਕੇ ਘਰ ਆਉਂਦਾ ਸੀ ਘਰ ਆਉਣ ਦੇ ਪਹਿਲਾਂ ਹੀ ਅਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕਰ ਦਿੰਦੇ ਸੀ ਅਤੇ ਜੇਕਰ ਕੋਈ ਸਮਾਨ ਬਾਹਰੋਂ ਆਇਆ ਹੋਵੇ ਉਸ ਨੂੰ ਵੀ ਪਹਿਲਾਂ ਸੈਨੇਟਾਈਜ਼ ਕਰਦੇ ਸੀ ਇਸ ਤਰ੍ਹਾਂ ਅਸੀਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਿਆ